ਪੰਜਾਬ ਪੁਲਿਸ ਅਤੇ ਸਰਕਾਰ ਬਹੁਤ ਬ ਮਿਹਨਤ ਕਰਦੇ ਹਨ ਜਿਵੇਂ ਕਿ ਦੁਰਘਟਨਾਵਾਂ ਨੂੰ ਰੋਕਣ ਵਾਸਤੇ ਥਾਂ ਥਾਂ 'ਤੇ ਕੈਮਰੇ ਅਤੇ ਬੱਤੀਆਂ 'ਤੇ ਪੁਲਿਸ ਮੁਲਾਜ਼ਮ ਖੜ੍ਹੇ ਹੁੰਦੇ ਹਨ ਅਤੇ ਜਿਵੇਂ ਕਿ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਪੁਲਿਸ ਮੁਲਾਜ਼ਮ ਘਰ ਘਰ ਜਾ ਕੇ ਲੋਕਾਂ ਨੂੰ ਨਸ਼ੇ ਦੇ ਵਿਰੁੱਧ ਬੱਚਿਆਂ ਨੂੰ ਜਾਣੂ ਕਰਵਾਉਂਦੇ ਹਨ ਕਿ ਨਸ਼ੇ ਤੋਂ ਦੂਰ ਰਹੋ ਨਸ਼ਾ ਸਿਹਤ ਲਈ ਹਾਨੀਕਾਰਕ ਹਨ ਜੇ ਕੋਈ ਗੁੰਡਾਗਰਦੀ ਕਰਦਾ ਹੈ ਚੋਰੀ ਡਕੈਤੀ ਕਰਦਾ ਹੈ ਤਾਂ ਤਾਂ ਤਾਂ ਸਰਕਾਰ ਅਤੇ ਪੁਲਿਸ ਮੁਲਾਜ਼ਮ ਲੋਕ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੰਦੀ ਹੈ ਅਤੇ ਜਿਹੜੇ ਜੋ ਜਨਸੰਖਿਆ ਘੱਟ ਜਨਸੰਖਿਆ ਜ਼ਿਆਦਾ ਅਤੇ ਪੁਲਿਸ ਮੁਲਾਜ਼ਮ ਘੱਟ ਹੈ ਜੇਕਰ ਸਾਨੂੰ ਸਾਨੂੰ ਸੌ ਨੰਬਰ 'ਤੇ ਫ਼ੋਨ ਕਰਦੇ ਹਨ ਜਾਂ ਉਹ ਸੌ ਨੰਬਰ ਬਿਜ਼ੀ ਆਉਂਦਾ ਹੈ ਅਤੇ ਜਾਂ ਉਹ ਟਾਈਮ 'ਤੇ ਨਹੀਂ ਪਹੁੰਚਦੇ